ਡਰੈਂਗ ਡਰੈਂਗ ਮੈਨੂੰ ਸ਼ੁਰੂ 'ਚੋਂ ਹੀ ਬਹੁਤ ਵਧੀਆ ਲੱਗਦੀ ਹੈ ਮੈਂ ਸਕੂਲ ਟਾਈਮ ਵਿੱਚ ਹੀ ਡਰੈਂਗ ਹੀ ਰੱਖੀ ਸੀ ਡਰੈਂਗ ਵਿੱਚ ਮੈਂ ਬਹੁਤ ਵਧੀਆ ਹਾਂ ਅਤੇ ਮੈਨੂੰ ਡਰੈਂਗ ਵਿੱਚ ਬਹੁਤ ਸਾਰੇ ਪੁਰਸਕਾਰ ਵੀ ਮਿਲੇ ਹਨ ਮੈਨੂੰ ਡਰੈਂਗ ਕਰਨਾ ਬਹੁਤ ਪਸੰਦ ਹੈ ਮੇਰੀ ਡਰੈਂਗ ਬਹੁਤ ਹੀ ਵਧੀਆ ਹੈ ਜਿਸ ਦਾ ਹੀ ਮੈਂ ਕੋਈ ਵਧੀਆ ਤੋਂ ਵਧੀਆ ਮੈਸੇਜ ਦੇ ਸਕਦੀ ਹਾਂ ਡਰੈਂਗ ਕਰਨਾ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਡਰੈਂਗ ਇੱਕ ਇਹੋ ਜਿਹਾ ਸਬਜੈਕਟ ਹੈ ਕਿ ਜਿਸ ਰਾਹੀਂ ਅਸੀਂ ਉਹ ਸਭ ਕੁਛ ਦਿਖਾ ਸਕਦੇ ਹਾਂ ਜੋ ਕਿ ਅਸੀਂ ਆਪਣੀ ਡਰੈਂਗ ਵਿੱਚ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਲੋਕਾਂ ਨੂੰ ਬਹੁਤ ਸਾਰਾ ਮੈਸਿਜ ਵੀ ਦੇ ਸਕਦੇ ਹਾਂ